ਸਤਿ ਸ਼੍ਰੀ ਅਕਾਲ ਜੀ ਅੱਜ ਭਾਰਤ ਵਿੱਚ ਸਭ ਤੋਂ ਮਹੱਤਵਪੂਰਨ ਚੁਣੌਤੀ ਇਹ ਹੈ ਕਿ ਭਾਰਤ ਦੀ ਜਿੰਨੀ ਵੀ ਜਨਤਾ ਹੈ ਉਹਨਾਂ ਵਿੱਚ ਗਰੀਬੀ ਨੂੰ ਘੱਟ ਕਰਨਾ ਭਾਰਤ ਵਿੱਚ ਗਰੀਬੀ ਬਹੁਤ ਹੀ ਜ਼ਿਆਦਾ ਵੱਧ ਰਹੀ ਹੈ ਕਿਉਂਕਿ ਭਾਰਤ ਦੇ ਵਿੱਚ ਬਹੁਤ ਹੀ ਜ਼ਿਆਦਾ ਜਨਤਾ ਵੀ ਵੱਧ ਰਹੀ ਹੈ ਜਿਹਦੇ ਕਾਰਣ ਜਨਤਾ ਨੂੰ ਕੰਮ ਨਹੀਂ ਮਿਲਦਾ ਅਤੇ ਉਹ ਭੁੱਖੇ ਵੀ ਰਹਿੰਦੇ ਹਨ ਜਿਹਦੇ ਕਾਰਣ ਗਰੀਬੀ ਬਹੁਤ ਹੀ ਜ਼ਿਆਦਾ ਵੱਧ ਰਹੀ ਹੈ ਇਸ ਚੁਣੌਤੀ ਨੂੰ ਦੂਰ ਕਰਨ ਦੇ ਲਈ ਪੰਜਾਬ ਸਰਕਾਰ ਆਪਣੀ ਪੂਰੀ ਮਿਹਨਤ ਕਰ ਰਹੀ ਹੈ ਜਿਵੇਂ ਕਿ ਸਰਕਾਰ ਨੇ ਇਸਤਰੀਆਂ ਦੇ ਲਈ ਰੋਡਵੇਜ਼ ਬੱਸਾਂ ਵੀ ਲਗਾਈਆਂ ਹਨ ਜਿਹਦੇ ਕਾਰਣ ਇਸਤਰੀਆਂ ਦਾ ਕੋਈ ਵੀ ਖਰਚਾ ਨਹੀਂ ਲੱਗਦਾ ਜੇਕਰ ਉਹ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਜਾਣ ਹੋਰ ਵੀ ਬਹੁਤ ਸਾਰੀਆਂ ਚੁਣੌਤੀਆਂ ਹਨ ਜਿਵੇਂ ਕਿ ਖਾਣ ਪੀਣ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਰਾਸ਼ਨ ਕਾਰਡ ਬਣਾਏ ਹਨ ਜਿਹਦੇ ਨਾਲ ਹਰ ਇੱਕ ਪਰਿਵਾਰ ਨੂੰ ਵੀਹ ਕਿਲੋ ਕਣਕ ਫਰੀ ਮਿਲਦੀ ਹੈ ਜਿਹਦੇ ਕਾਰਣ ਉਹ ਆਪਣੀ ਰੋਜ਼ੀ ਰੋਟੀ ਨੂੰ ਪੂਰਾ ਕਰ ਸਕਦੇ ਹਨ ਹੋਰ ਵੀ ਬਹੁਤ ਸਾਰੀਆਂ ਚੁਣੌਤੀਆਂ ਹਨ ਜੋ ਕਿ ਪੰਜਾਬ ਸਰਕਾਰ ਨੇ ਦੂਰ ਕੀਤੀਆਂ ਹਨ ਜਿਹਦੇ ਕਾਰਣ ਪੰਜਾਬ ਦੇ ਲੋਕਾਂ ਨੂੰ ਬਹੁਤ ਹੀ ਆਸਾਨੀ ਹੈ ਗਰੀਬੀ ਦੇ ਵਧਣ ਦੇ ਨਾਲ ਲੋਕਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਤਣਾਅ ਵੀ ਆ ਜਾਂਦਾ ਹੈ ਜਿਹਦੇ ਕਾਰਣ ਲੋਕਾਂ ਦੇ ਵਿੱਚ ਗੁੱਸਾ ਵੀ ਆ ਜਾਂਦਾ ਹੈ ਲੋਕਾਂ ਨੂੰ ਨੌਕਰੀਆਂ ਨਾ ਮਿਲਣ ਕਾਰਣ ਜਾਂ ਫਿਰ ਨੌਕਰੀਆਂ ਵਿੱਚ ਘੱਟ ਤਨਖਾਹ ਮਿਲਣ ਦੇ ਕਾਰਣ ਲੋਕ ਬਹੁਤ ਹੀ ਜ਼ਿਆਦਾ ਪਰੇਸ਼ਾਨ ਵੀ ਰਹਿੰਦੇ ਹਨ ਪੰਜਾਬ ਸਰਕਾਰ ਆਪਣੀ ਪੂਰੀ ਮਿਹਨਤ ਕਰ ਰਹੀ ਹੈ ਕਿ ਉਹ ਇਹ ਸਭ ਚੁਣੌਤੀਆਂ ਨੂੰ ਜਲਦੀ ਤੋਂ ਜਲਦੀ ਹੱਲ ਕਰ ਸਕਣ ਧੰਨਵਾਦ ਜੀ